ਭਾਰਤ ਵਿਚ ਬਹੁਤ ਸਾਰੇ ਵਪਾਰੀ ਉਦਯੋਗਪਤੀ ਅਤੇ ਨੇਤਾ ਅਤੇ ਜਿਨ੍ਹਾਂ ਨੇ ਮਤਲਬ ਕਈ ਤਰੀਕਿਆਂ ਨਾਲ ਭਾਰਤ ਨੂੰ ਬਦਲਿਆ ਜਿਵੇਂ ਟੈਕਨੋਲਜੀ ਸਿੱਖਿਆ ਮਨੋਰੰਜਨ ਵਪਾਰ ਅਤੇ ਆਵਾਜਾਈ ਇਹਨਾਂ ਵਿੱਚੋਂ ਮੈਂ ਕਿਸੇ ਨੂੰ ਖ਼ਾਸ ਤਾਂ ਨਹੀਂ ਜਾਣਦੀ ਪਰ ਜਿੱਥੇ ਜਿਹੜੇ ਬਦਲਾਅ ਆਏ ਜਿਸ ਤਰ੍ਹਾਂ ਮੈਂ ਗੱਲ ਕਰੀਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਆ ਕੇ ਸਭ ਤੋਂ ਪਹਿਲਾਂ ਤਾਂ ਬਿਜਲੀ ਮਾਫ਼ ਕੀਤੀ ਹੈ ਜਿਹਦੇ ਵਿੱਚ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ ਕਿਉਂਕਿ ਬਿਜਲੀ ਮਾਫ਼ ਕਰਨ ਨਾਲ ਲੋਕਾਂ ਨੇ ਹੈ ਕਿ ਜਿਹੜੇ ਹਰ ਦੋ ਮਹੀਨੇ ਬਾਅਦ ਉਹਨਾਂ ਦੇ ਬਿਜਲੀ ਦਾ ਖਰਚਾ ਇੰਨਾ ਇੰਨਾ ਹੁੰਦਾ ਸੀ ਅਤੇ ਉਹ ਉਹਨਾਂ ਨੂੰ ਕਾਫੀ ਰਾਹਤ ਮਿਲੀ ਆ ਕਿ ਉਹ ਜਿਹੜੇ ਪੈਸੇ ਉਹਨਾਂ ਦੇ ਸੇਵ ਹੋ ਰਹੇ ਆ ਉਹ ਪੈਸੇ ਨੂੰ ਕਿਤੇ ਹੋਰ ਵਰਤ ਰਹੇ ਆ ਅਤੇ ਉਹਦੇ ਨਾਲ ਕੀ ਹੋਇਆ ਕਿ ਬਿਜਲੀ ਤੋਂ ਚੱਲਣ ਵਾਲੇ ਕਈ ਚੀਜ਼ਾਂ ਉਹਨਾਂ ਨੇ ਆਪਣੇ ਘਰ 'ਚ ਲਿਆਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਬਿੱਲ ਤਾਂ ਹੁਣ ਆਉਣਾ ਨਹੀਂ ਅਸੀਂ ਇਹ ਵਾਲਾ ਹਿੱਸਾ ਮੰਨ ਲਓ ਕਿ ਇੰਡਕਸ਼ਨ ਹੈ ਜਾਂ ਮਾਈਕ੍ਰੋਵੇਵ ਆ ਜਾਂ ਹੀਟਰ ਹੈ ਅਤੇ ਪ੍ਰੈਸ ਜਿੱਦਾਂ ਮੰਨ ਲੋ ਕਿ ਜਿਹੜੇ ਧੋਬੀ ਆ ਮੰਨ ਲਉ ਕਿ ਉਹ ਪ੍ਰੈਸ ਕੱਪੜੇ ਕਰਦੇ ਸੀ ਉਹਨਾਂ ਨੇ ਹੁਣ ਬਿਜਲੀ ਦੀਆਂ ਪ੍ਰੈਸਾਂ ਯੂਜ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਕੋਲੇ ਵੀ ਵਰਤਦੇ ਹੁੰਦੇ ਸੀ ਕੋਲਿਆਂ ਵਾਸਤੇ ਉਹਨਾਂ ਨੂੰ ਬਾਹਰ ਪੈਸੇ ਖਰਚਣੇ ਪੈਂਦੇ ਸੀ ਹੁਣ ਉਹ ਬਿਜਲੀ ਦੀਆਂ ਚਲਾਉਂਦੇ ਆ ਜਨਾਨੀਆਂ ਨੇ ਘਰ 'ਚ ਇੰਡਕਸ਼ਨ ਲੈ ਆਂਦੇ ਆ ਕਿ ਸਾਡੀ ਗੈਸ ਦੀ ਵੀ ਬੱਚਤ ਹੋ ਜਾਏਗੀ ਸਾਡੇ ਇੱਧਰੋਂ ਇਹ ਵੀ ਪੈਸੇ ਬਚ ਜਾਣਗੇ ਅਤੇ ਸਾਡੇ ਉੱਧਰੋਂ ਇੰਡਕਸ਼ਨ ਚਲਾਉਣ ਦੇ ਨਾਲ ਸਾਡੇ ਮਤਲਬ ਬਿਜਲੀ ਦਾ ਜਿਹੜਾ ਬਿਲ ਆ ਬਿਲ ਤਾਂ ਮਾਫ਼ ਹੋਇਆ ਹੀ ਹੈ ਅਤੇ ਜਿਨ੍ਹਾਂ ਨੇ ਘਰ ਵਿੱਚ ਲੋਕ ਏ ਸੀ ਨਹੀਂ ਸੀ ਲਵਾ ਸਕਦੇ ਹੁਣ ਉਹਨਾਂ ਨੇ ਵੀ ਛੋਟੇ ਛੋਟੇ ਏ ਸੀ ਲਵਾ ਲਏ ਆ ਕਿ ਚਲੋ ਉਹ ਨੇਮ ਬਿਲ ਦੇ ਅੰਦਰ ਅੰਦਰ ਸਾਡਾ ਜੀ ਇੰਨਾ ਕੁ ਬਿਲ ਆ ਜਾਣਾ ਅਤੇ ਉਹ ਇੰਨੇ ਕੁ ਯੂਨਿਟ ਬਲ ਜਾਣੇ ਛੇ ਸੌ ਦੇ ਅੰਦਰ ਅੰਦਰ ਅਤੇ ਸਾਡਾ ਬਿਲ ਆਉਣਾ ਨਹੀਂ ਅਸੀਂ ਏ ਸੀ ਵੀ ਲਗਵਾ ਲੈਦੇ ਹਾਂ ਸਰਦੀਆਂ ਨੂੰ ਲੋਕ ਗੀਜ਼ਰ ਵੀ ਹਰ ਘਰ 'ਚ ਕਾਫੀ ਘਰਾਂ 'ਚ ਲੱਗ ਚੁੱਕੇ ਆ ਗੀਜ਼ਰ ਕਿਉਂਕਿ ਉਹ ਵੀ ਬਿਜਲੀ ਨਾਲ ਹੀ ਚੱਲਦੇ ਆ ਇਸ ਤਰ੍ਹਾਂ ਮਤਲਬ ਕਿ ਆਮ ਆਦਮੀ ਸਰਕਾਰ ਨੇ ਬਿਜਲੀ ਦੇ ਫਰੀ ਕਰਕੇ ਕਾਫੀ ਲੋਕਾਂ ਨੂੰ ਫਾਇਦਾ ਦਿੱਤਾ